ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਾ ਕਾਰਨ ਨੌਜਵਾਨਾਂ ਵਿੱਚ ਸਕਿੱਲ ਦੀ ਘਾਟ ਹੈ ਸਾਡੀ ਸਿੱਖਿਆ ਪ੍ਰਣਾਲੀ ਨੌਜਵਾਨਾਂ ਨੂੰ ਕਿਤਾਬੀ ਗਿਆਨ ਤਾਂ ਦਿੰਦੀ ਹੈ ਪਰ ਉਹਨਾਂ ਨੂੰ ਆਪਣੇ ਕਿੱਤੇ 'ਚ ਨਿਪੁੰਨ ਨਹੀਂ ਬਣਾਉਂਦੀ ਕਿੱਤਾ ਕੋਰਸਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ ਵਿਦਿਆਰਥੀ ਕਈ ਕਈ ਡਿਗਰੀਆਂ ਲਈ ਫਿਰਦੇ ਹਨ ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਸਾਇੰਸ ਅਤੇ ਖੇਤੀਬਾੜੀ ਕਈ ਅਜਿਹੀਆਂ ਸ਼੍ਰੇਣੀਆਂ ਹਨ ਜਿਹਨਾਂ ਵਿੱਚ ਹੋਰ ਖੋਜ ਕਰਨ ਦੀ ਲੋੜ ਹੈ ਜਿਹਨਾਂ ਵੱਲ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ ਜਿੰਨਾਂ ਪੈਸਾ ਨੌਜਵਾਨ ਵਿਦੇਸ਼ਾਂ 'ਚ ਪੜ੍ਹਾਈ ਲਈ ਲਗਾਉਂਦੇ ਹਨ ਅਗਰ ਉਹਨਾਂ ਨੂੰ ਇੱਥੇ ਹੀ ਉਹਨਾਂ ਦੀ ਰੁਚੀ ਦੇ ਕੰਮ ਦੀ ਸਿੱਖਿਆ ਦੇ ਕੇ ਕਿੱਤਾ ਖੋਲ੍ਹਿਆ ਜਾਵੇ ਤਾਂ ਨੌਜਵਾਨ ਇੱਥੇ ਪੈਸੇ ਵੀ ਕਮਾ ਸਕਣਗੇ ਅਤੇ ਆਪਣੇ ਘਰਾਂ ਤੋਂ ਵੀ ਦੂਰ ਨਹੀਂ ਹੋਣਗੇ ਹੋਰ ਨੌਕਰੀਆਂ ਪੈਦਾ ਕਰਨ ਲਈ ਸਰਕਾਰ ਨੂੰ ਨਵੇਂ ਨਵੇਂ ਪ੍ਰੋਜੈਕਟ ਲਾਣੇ ਚਾਹੀਦੇ ਹਨ ਅਤੇ ਨੌਜਵਾਨਾਂ ਨੂੰ ਸਿਖਲਾਈ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਦੇਸ਼ 'ਚ ਰਹਿ ਕੇ ਹੀ ਕਮਾਈ ਕਰ ਸਕਣ ਅਤੇ ਕਾਮਯਾਬ ਹੋ ਸਕਣ ਅਤੇ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਣ